ਸਤਿ ਸ਼੍ਰੀ ਅਕਾਲ ਜੀ ਡੋਮੀਨੋਜ਼ ਤੋਂ ਬੋਲ਼ਦੇ ਜੀ ਮੈਂ ਨਾ ਓਡਰ ਕੀਤਾ ਸੀ ਕੈਪਸੀਕਮ ਓਨੀਅਨ ਪੀਜ਼ਾ ਉਹ ਆਡਰ ਮੇਰੇ ਦਫਤਰ ਦੇ ਭੇਜਿਆ ਕਿਆ ਕਿਆ